ਹੈਲੋ ਹਾਂਜੀ ਅ ਤੁਸੀਂ ਸੰਜੀਵ ਜੀ ਬੋਲ ਰਹੇ ਹੋ ਅ ਤੁਸੀਂ ਸਰ ਮੇਰੇ ਤੋਂ ਇੱਕ ਸਾਲ ਸੀਨੀਅਰ ਸੀ ਜੀ ਸਰ ਮੈਨੂੰ ਨਾ ਤੁਸੀਂ ਇਹ ਦੱਸੋਗੇ ਕਿ ਪੰਜਾਬ 'ਚ ਕਿਹੜੀ ਕਿਹੜੀ ਯੂਨੀਵਰਸਿਟੀਜ਼ ਨੇ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਬਠਿੰਡੇ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚੋਂ ਜੀ ਮੈਨੂੰ ਦੱਸੋ ਵੀ ਇਹ ਜਿਹੜੇ ਸਰਕਾਰੀ ਨੇ ਅਤੇ ਅ ਪ੍ਰਾਈਵੇਟ ਨੇ ਉਹ ਕਿਹੜੀਆਂ ਕਿਹੜੀਆਂ ਨੇ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਵੀਰ ਜੀ ਤੁਸੀਂ ਮੇਰੇ ਤੋਂ ਇੱਕ ਸਾਲ ਸੀਨੀਅਰ ਸੀ ਨਾ ਜੀ ਤਾਂ ਤੁਸੀਂ ਕਿਹੜੀ ਯੂਨੀਵਰਸਿਟੀ ਵਿੱਚ ਐਡਮਿਸ਼ਨ ਲਿਤੀ ਹੈ ਅੱਛਾ ਜੀ ਠੀਕ ਹੈ ਜੀ ਅਤੇ ਤੁਸੀਂ ਬੰਦਾ ਬਹਾਦਰ ਕੋਲਜ ਵਿੱਚ ਪੜ੍ਹੇ ਹੋ ਜੋ ਕਿ ਫਤਿਹਗੜ੍ਹ ਸਾਹਿਬ ਵਿੱਚ ਹੈ ਜੀ ਅਤੇ ਇਸਦੀ ਸਰ ਇਹਦੀ ਅ ਮੈਂ ਇਹਦੀ ਵੀਰ ਜੀ ਜਿਹੜੀ ਯੂਨੀਵਰਸਿਟੀ ਦੀ ਪਲੇਸਮੈਂਟ ਕਿਹੜੀ ਹੈਗੀ ਇਸ ਦੀ ਅੱਛਾ ਜੀ ਹਾਂਜੀ ਤੁਸੀਂ ਵੈਸੇ ਵੀ ਬਹੁਤ ਹੁਸ਼ਿਆਰ ਸੀ ਪਹਿਲਾਂ ਵੀ ਪੜ੍ਹਾਈ ਦੇ ਵਿੱਚ ਤਾਂ ਤੁਹਾਡੀ ਹੋ ਜਾਏਗੀ ਅਤੇ ਮੈਨੂੰ ਕਿਹੜੀ ਯੂਨੀਵਰਸਿਟੀ ਵਿੱਚ ਲੈਣੀ ਚਾਹੀਦੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਓਕੇ